ਸਤਿ ਸ਼੍ਰੀ ਅਕਾਲ ਜੀ ਅੱਛਾ ਅੱਛਾ ਹਾਂਜੀ ਭਾਅ ਜੀ ਤੁਸੀਂ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਉ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਾਫ਼ੀ ਜਿਹੜੇ ਤਿਉਹਾਰ ਮਨਾਏ ਜਾਂਦੇ ਹਨ ਜਿੱਦਾਂ ਬਸੰਤ ਪੰਚਮੀ ਹੈ ਤੀਆਂ ਦਾ ਤਿਉਹਾਰ ਹੈ ਗੁਰਪੁਰਬ ਲੱਗਦਾ ਇੱਥੇ ਗੁਰਪੁਰਬ ਵਿੱਚ ਇੱਥੇ ਲੋਕ ਲੰਗਰ ਲਾਉਂਦੇ ਨੇ ਹਨ ਅੱਜ ਕੱਲ੍ਹ ਤਾਂ ਆ ਦੇਖੋ ਸ਼ਨੀਵਾਰ ਹੈਗਾ ਹੈ ਸ਼ਨੀਵਾਰ ਐਤਵਾਰ ਚੁਪਹਿਰਾ ਲੱਗਦਾ ਸਾਡੇ ਇੱਥੇ ਲੋਕ ਵੱਖ ਵੱਖ ਥਾਵਾਂ ਤੋਂ ਆਉਂਦੇ ਹਨ ਇੱਥੇ ਅਤੇ ਵਧੀਆ ਵਧੀਆ ਲੋਕ ਇੱਥੇ ਆ ਕੇ ਆਪਣਾ ਉਹ ਕਰਦੇ ਹਨ ਪਾਠ ਪੂਠ ਕਰਦੇ ਹਨ ਆਪਣਾ ਚੁਪਹਿਰਾ ਕਰਦੇ ਹਨ ਅਤੇ ਪਿੰਡਾਂ 'ਚ ਚਲੇ ਜਾਂਦੇ ਹਨ ਇੱਥੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਨਾ ਸਵੇਰੇ ਲੋਕ ਆਪਣੇ ਗੁੱਡੇ ਉਡਾਉਂਦੇ ਹਨ ਅਤੇ ਰਾਤ ਆਪਣੀ ਲੋਹੜੀ ਬਾਲ ਲੈਂਦੇ ਹਨ ਹੋਰ ਵੀ ਕਾਫ਼ੀ ਤਿਉਹਾਰ ਜਿਹੜੇ ਲੋਕ ਇੱਥੇ ਮਨਾਉਂਦੇ ਹਾਂ ਜਿੱਦਾਂ ਇੱਥੇ ਹੋਲੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ ਹੋਰ ਵੀ ਵੱਖਰੇ ਵੱਖਰੇ ਜਿਹੜੇ ਤਿਉਹਾਰ ਇੱਥੇ ਮਨਾਏ ਜਾਂਦੇ ਹਨ ਇੱਥੇ ਇੱਕ ਪਾਸੇ ਠੀਕ ਹੈ ਭਾਅ ਜੀ